ਹਾਡਬਲ ਸਿਰ ਕਰਕੇ ਨਹੀਂ ਸੌਂਈ ਦਾ ਦੂਜਾ ਮੰਗਲਵਾਰ ਵੀਰਵਾਰ ਅਤੇ ਸ਼ਨੀਵਾਰ ਵਾਲ ਨਹੀਂ ਕਟਵਾਉਣੇ ਦਾੜ੍ਹੀ ਨਹੀਂ ਕਟਵਾਉਣੀ ਤੀਜਾ ਮੰਗਲਵਾਰ ਵੀਰਵਾਰ ਅਤੇ ਸ਼ਨੀਵਾਰ ਕੱਪੜੇ ਨਹੀਂ ਧੋਣੇ ਚਾਹੀਦੇ ਚੌਥਾ ਜ਼ਮੀਨ 'ਤੇ ਲੂਣ ਨਹੀਂ ਸੁੱਟਣਾ ਚਾਹੀਦਾ ਪੰਜਵਾਂ ਜੇ ਬਿੱਲੀ ਰਸਤਾ ਕੱਟ ਜਾਏ ਤਾਂ ਉਸ ਰਸਤੇ ਤੋਂ ਨਹੀਂ ਜਾਈਦਾ ਮੁੜ ਜਾਈਦਾ ਹੈ ਕੰਮ ਨਹੀਂ ਬਣਦਾ ਅਗਲਾ ਜੇ ਤੁਸੀਂ ਕੰਮ 'ਤੇ ਨਿਕਲਣ ਲੱਗੇ ਹੋ ਕਿਸੇ ਨੂੰ ਛਿੱਕ ਆ ਗਈ ਉੱਥੇ ਖੜ੍ਹ ਜਾਓ ਕਿਉਂਕਿ ਤੁਹਾਡਾ ਕੰਮ ਨਹੀਂ ਜੇ ਬਣਨਾ ਠੀਕ ਹੈ ਜੀ ਉਸ ਤੋਂ ਬਾਅਦ ਹੁੰਦਾ ਮੰਦਰ ਵੱਲ ਪੈਰ ਕਰਕੇ ਨਹੀਂ ਸੌਣਾ ਚਾਹੀਦਾ ਇੱਦਾਂ ਰੱਬ ਦੀ ਬੇਇਜ਼ਤੀ ਗਿਣੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਹੈਗਾ ਕਿ ਕਾਲਾ ਕੱਪੜਾ ਨਹੀਂ ਪਾਉਣਾ ਚਾਹੀਦਾ ਚੰਗੇ ਵੇਲੇ ਅਤੇ ਸ਼ਗਨਾ ਵਾਲੇ ਮੌਕੇ 'ਤੇ ਚਿੱਟਾ ਜਾਂ ਕਾਲਾ ਰੰਗ ਨਹੀਂ ਪਾਉਣਾ ਚਾਹੀਦਾ